ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਤਨੂੰ ਕੁਮਾਰੀ ਬੋਲ ਰਹੀ ਹਾਂ ਤੁਸੀਂ ਰੀਤ ਟੂਰ ਐਂਡ ਟਰੈਵਲਸ ਤੋਂ ਗੱਲ ਕਰ ਰਹੇ ਹੈ ਮੈਨੂੰ ਤੁਹਾਡਾ ਨੰਬਰ ਮੇਰੇ ਫਰੈਂਡ ਨੇ ਦਿੱਤਾ ਏ ਮੈਂ ਮੈਂ ਨਵਾਂਸ਼ਹਿਰ ਦੀ ਹਾਂ ਮੈਂ ਨਾ ਨਵਾਂਸ਼ਹਿਰ ਤੋਂ ਮਤਲਬ ਪਟਿਆਲੇ ਘੁੰਮਣ ਆਉਣਾ ਏ ਅਤੇ ਮੈਂ ਤੁਹਾਨੂੰ ਇਹ ਪੁੱਛਣਾ ਤਾਂ ਕਿ ਮਤਲਬ ਕਿੰਨਾ ਤੁਹਾਡੇ ਕੋਲ ਕੈਬ ਵਗੈਰਾ ਹੈਗਾ ਏ ਅਤੇ ਘੁੰਮਣ ਘੁੰਮਣਾ ਏ ਮੈਂ ਮਤਲਬ ਉਥੇ ਦੇਖਣਾ ਏ ਉਸ ਤੋਂ ਬਾਅਦ ਮਤਲਬ ਕਿੰਨਾ ਕੁ ਖਰਚਾ ਹੋਜੂਂਗਾ ਘੁੰਮਣ ਫਿਰਨ ਦਾ ਜਿੱਦਾਂ ਤੁਹਾਡੇ ਕੋਲ ਸੀਟਾਂ ਕਿੰਨੀਆਂ ਹੈਗੀਆਂ ਚਾਰ ਜਾਂ ਦੋ ਕਿੰਨੇ ਹੈਗੇ ਉਸ ਹਿਸਾਬ ਨਾਲ ਪੈਸੇ ਲੱਗਣੇ ਕਿੱਦਾਂ ਕਿਆ ਏ ਮੈਨੂੰ ਦੱਸਦੋ ਤੁਸੀਂ ਮੈਂ ਨਾ ਅੱਠ ਤਰੀਕ ਨੂੰ ਆਉਣਾ ਉਥੇ ਘੁੰਮਣ ਅਤੇ ਮੈਂ ਇੱਕ ਦਿਨ ਪਹਿਲਾਂ ਤੁਹਾਨੂੰ ਫੋਨ ਕਰਨਾ ਕਿ ਉੱਥੇ ਦਾ ਕਿਆ ਏ ਕਿੱਦਾਂ ਏ ਮੈਂ ਘੁੰਮਣਾ ਏ ਉਥੇ ਆ ਕੇ ਮੈਂ ਤੁਹਾਨੂੰ ਆਪਣਾ ਨੰਬਰ ਵੱਟਸਐਪ ਕਰ ਦੇਣਾ ਅਤੇ ਤੁਸੀਂ ਮੇਰਾ ਧਿਆਨ ਰੱਖਿਓ ਇੱਕ ਵਾਰੀ ਧੰਨਵਾਦ